ਹਾਂਜੀ ਅਸੀਂ ਸਭ ਤੋਂ ਸੁੰਦਰ ਯਾਤਰਾ ਜਿਹੜੀ ਆ ਉਹ ਅਰੁਣਾਚਲ ਪ੍ਰਦੇਸ਼ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਕੀਤੀ ਸੀਗੀ ਅਸੀਂ ਬਾਈ ਟ੍ਰੇਨ ਇੱਥੋਂ ਗਏ ਸੀਗੇ ਸਾਨੂੰ ਬਹੁਤ ਹੀ ਵਧੀਆ ਯਾਤਰਾ ਲੱਗੀ ਰਸਤੇ ਦੇ ਵਿੱਚ ਬਹੁਤ ਕੁਛ ਦੇਖਣ ਨੂੰ ਮਿਲਿਆ ਹਜ਼ੂਰ ਸਾਹਿਬ ਅਸੀਂ ਜਿੰਨੇ ਵੀ ਉੱਥੇ ਗੁਰਦੁਆਰਾ ਸਾਹਿਬ ਨੇ ਸਾਰਿਆਂ ਦੇ ਦਰਸ਼ਨ ਕੀਤੇ ਤਕਰੀਬਨ ਦਸ ਤੋਂ ਗਿਆਰਾਂ ਦਿਨ ਦੇ ਵਿੱਚ ਅਸੀਂ ਇਹ ਯਾਤਰਾ ਪੂਰੀ ਕਰਕੇ ਵਾਪਸ ਆ ਗਏ ਸਾਨੂੰ ਸਾਰੇ ਧਰਮਾਂ ਦੇ ਲੋਕ ਉਸ ਜਗ੍ਹਾ 'ਤੇ ਮਿਲੇ ਜਿਹਨਾਂ ਨੂੰ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਇਹ ਯਾਤਰਾ ਬਹੁਤ ਸੁੰਦਰ ਸੀ ਅਰੁਣਾਚਲ ਦੇ ਵਿੱਚ ਦੇਖੋ ਜੀ ਤੁਸੀਂ ਜਦੋਂ ਅਸੀਂ ਅਰੁਣਾਚਲ ਦੇ ਵਿੱਚ ਗਏ ਉਸ ਯਾਤਰਾ ਦੇ ਵਿੱਚ ਕੀ ਆ ਉੱਥੇ ਜਿਹੜਾ ਸੂਰਜ ਆ ਮੰਨ ਲਓ ਆਪਣੇ ਇੱਥੇ ਪੰਜਾਬ ਦੇ ਵਿੱਚ ਸੱਤ ਵਜੇ ਡੁੱਬਦਾ ਤਾਂ ਤਕਰੀਬਨ ਦੋ ਘੰਟੇ ਪਹਿਲਾਂ ਦਾ ਫਰਕ ਆ ਸੂਰਜ ਉੱਥੇ ਦੋ ਘੰਟੇ ਪਹਿਲਾਂ ਕੀ ਆ ਛਿਪਦਾ ਇਸ ਤਰੀਕੇ ਦੇ ਨਾਲ ਹੀ ਸੂਰਜ ਆ ਜਿਹੜਾ ਦੋ ਘੰਟੇ ਪਹਿਲਾਂ ਤੜਕੇ ਉਦੇ ਹੁੰਦਾ ਯਾਨੀ ਕਿ ਸਭ ਤੋਂ ਪਹਿਲਾਂ ਕੀ ਆ ਜਿਹੜਾ ਸੂਰਜ ਆ ਉੱਥੇ ਚੜ੍ਹਦਾ ਬਾਕੀ ਉੱਧਰਲੇ ਜਿਹੜੇ ਲੋਕ ਆ ਉਹ ਖੇਤੀਬਾੜੀ ਕੀ ਕਰਦੇ ਆ ਕਿੱਦਾ ਦਾ ਪਹਿਰਾਵਾ ਉਹਨਾਂ ਦਾ ਸਾਰਾ ਕੁਛ ਕੀ ਹੈ ਸਾਨੂੰ ਇਹ ਯਾਤਰਾ ਤੋਂ ਸਿੱਖਣ ਨੂੰ ਮਿਲਿਆ ਜਿਹੜੀ ਸਾਡੀ ਇਹ ਯਾਤਰਾ ਸੀ ਬਹੁਤ ਹੀ ਵਧੀਆ ਯਾਤਰਾ ਸੀਗੀ ਅਸੀਂ ਪਹਿਲੀ ਵਾਰੀ ਇਹ ਯਾਤਰਾ ਕੀਤੀ ਬਹੁਤ ਵਧੀਆ ਲੱਗਿਆ ਸਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਰੁਣਾਚਲ ਦੇ ਵਿੱਚ ਅਸੀਂ ਜਿਵੇਂ ਡਿਬਰੂਗੜ੍ਹ ਜਨਜਾਨ ਅਸਾਮ ਹੈ ਅਸਾਮ ਨੇ ਡਿਬਰੂਗੜ੍ਹ ਉੱਧਰ ਚਾਹ ਦੇ ਬਾਗ ਨੇ ਉਹ ਸਾਨੂੰ ਬਹੁਤ ਵਧੀਆ ਲੱਗੇ ਦੇਖ ਕੇ ਯਾਤਰਾ ਇਹ ਸਾਡੇ ਲਈ ਬਹੁਤ ਵਧੀਆ ਸੀ ਧੰਨਵਾਦ ਜੀ